ਮੇਰੇ ਕੋਲ ਪਹਿਲਾਂ ਕੀਪੈਡ ਫ਼ੋਨ ਸੀ ਨੋਕੀਆ ਦਾ ਜੋ ਕਿ ਸਿੰਗਲ ਸਿਮ ਇੱਕ ਮੈਂਬਰੀ ਕਾਰਡ ਸੀ ਜਿਹਦੇ ਵਿੱਚ ਪੈਂਦਾ ਸੀ ਜੋ ਕਿ ਉਸ ਟਾਈਮ ਉਸ ਦੇ ਨਾਲ ਹੀ ਬਹੁਤ ਵਧੀਆ ਇੰਜੋਮੈਂਟ ਕਰਦੇ ਸੀ ਉਸ ਤੋਂ ਬਾਅਦ ਟੈਕਨੋਲਜੀ ਚੇਂਜ ਹੁੰਦੀ ਹੁੰਦੀ ਸੈਮਸੰਗ ਸੀ ਟੂ ਜੋ ਕਿ ਟੂ ਜੀ ਨੈਟਵਰਕ ਵਾਲਾ ਫ਼ੋਨ ਸੀ ਜੋ ਕਿ ਡਬਲ ਸਿਮ ਸਿੰਗਲ ਮੈਮਰੀ ਕਾਰਡ ਐਂਡ ਇੰਟਰਨੈਟ ਸਲੋਅ ਇੰਟਰਨੈਟ ਚੱਲਦਾ ਸੀ ਪਰ ਔਰ ਉਸ ਦੇ ਵਿੱਚ ਵੀ ਬਹੁਤ ਵਧੀਆ ਇੰਜੋਏ ਕਰਦੇ ਰਹੇ ਉਸ ਤੋਂ ਬਾਅਦ ਟੈਕਨੋਲਜੀ ਚੇਂਜ ਹੁੰਦਿਆਂ ਹੁੰਦਿਆਂ ਫੋਰ ਜੀ ਆ ਗਏ ਫੋਰ ਜੀ ਤੋਂ ਡਬਲ ਸਿਮ ਮੈਮਰੀ ਕਾਰਡ ਮਤਲਬ ਬੈਂਟਰੀ ਪੈਕਅੱਪ ਬੈਟਰੀ ਪੈਕਅੱਪ ਰੈਮ ਵਗੈਰਾ ਹਰ ਇੱਕ ਚੀਜ਼ ਦੀ ਜੋ ਕਿ ਕਾਫੀ ਟੈਕਨੋਲੋਜੀ ਚੇਂਜ ਹੋਈ ਜੋ ਕਿ ਹੁਣ ਫੋਰ ਜੀ ਨੈੱਟ ਫਾਈਵ ਜੀ ਤੱਕ ਵੀ ਪਹੁੰਚ ਚੁੱਕਾ ਹੈ ਜੋ ਕਿ ਬਹੁਤ ਹੀ ਫਾਸਟ ਇੰਟਰਨੈਟ ਦੀ ਸੇਵਾ ਹਰ ਇੱਕ ਨੂੰ ਬਹੁਤ ਹੀ ਵਧੀਆ ਲੱਗਦੀ ਹੈ ਮੋਬਾਇਲ ਫ਼ੋਨ